ਪੰਜਾਬ ਇੱਕ ਪੜ੍ਹਿਆ ਲਿਖਿਆ ਸੂਬਾ ਹੈ ਅਤੇ ਪੰਜਾਬ ਦੀ ਸਾਖਰਤਾ ਦਰ ਪੰਝੱਤਰ ਪੋਆਇੰਟ ਚੁਰਾਸੀ ਹੈ ਅਤੇ ਭਾਰਤ ਦੀ ਸਾਖਰਤਾ ਦਰ ਇਸ ਦੇ ਮੁਕਾਬਲੇ ਬਹੱਤਰ ਪੋਆਇੰਟ ਅਠਾਨਵੇਂ ਹੈ ਪੰਜਾਬ ਵਿੱਚ ਪੁਰਸ਼ਾਂ ਦੀ ਕੁੱਲ ਸਾਖਰਤਾ ਦਰ ਅੱਸੀ ਪੋਆਇੰਟ ਚੁਤਾਲੀ ਅਤੇ ਮਹਿਲਾ ਦੀ ਸੁਪਰ ਸਾਖਰਤਾ ਦਰ ਸੱਤਰ ਪੋਆਇੰਟ ਤਿਹੱਤਰ ਹੈ ਭਾਰਤ ਦੀ ਮਹਿਲਾ ਸਾਖਰਤਾ ਦਰ ਪੈਂਹਠ ਪੈਂਹਠ ਚੁਰਾਸੀ ਹੈ ਜ ਅਤੇ ਇਸ ਮੁਕਾਬਲੇ ਪੰਜਾਬ ਦੀ ਜੋ ਮਹਿਲਾ ਦਰ ਹੈ ਉਹ ਕਾਫੀ ਜ਼ਿਆਦਾ ਹੈ ਹੁਸ਼ਿਆਰਪੁਰ ਸਭ ਤੋਂ ਵੱਧ ਪੜ੍ਹਿਆ ਲਿਖਿਆ ਸੂਬਾ ਹੈ ਸੂਬੇ ਵਿੱਚ ਜ਼ਿਲ੍ਹਾ ਹੈ ਜਿਸ ਵਿੱਚ ਮਹਿਲਾਵਾਂ ਦੀ ਗਿਣਤੀ ਇਕਾਸੀ ਪੋਆਇੰਟ ਅਠਤਾਲੀ ਹੈ ਇਸ ਤਰ੍ਹਾਂ ਭਾਰਤ ਦੇ ਕਈ ਰਾਜਾਂ ਦੇ ਮੁਕਾਬਲੇ ਭਾ ਪੰਜਾਬ ਕਾਫੀ ਪੜ੍ਹਿਆ ਲਿਖਿਆ ਸੂਬਾ ਹੈ